ਮੈਂ ਆਪਣੇ ਜੀਵਨ ਬਚਪਨ ਵਿੱਚ ਆਪਣੇ ਦਾਦੇ ਪੜਦਾਦਿਆਂ ਤੋਂ ਬਹੁਤ ਹੀ ਕਹਾਣੀਆਂ ਸੁਣੀਆਂ ਹਨ ਜਿਹਨਾਂ ਵਿੱਚ ਸਰਦਾਰ ਊਧਮ ਸਿੰਘ ਸਰਦਾਰ ਭਗਤ ਸਿੰਘ ਬਹੁਤ ਹੀ ਜ਼ਿਆਦਾ ਸਤਿਕਾਰਯੋਗ ਹਨ ਸਰਦਾਰ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਉਸ ਤੋਂ ਪੰਜਾਬ ਵਿੱਚ ਹੋਏ ਕਤਲੇਆਮ ਦਾ ਬਦਲਾ ਲਿਆ ਜਦੋਂ ਜਨਰਲ ਡਾਇਰ ਨੇ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਬਹੁਤ ਸਾਰੇ ਪੰਜਾਬੀ ਨਿਹੱਥਿਆ ਦੇ ਉੱਤੇ ਗੋਲੀਆਂ ਚਲਵਾਈਆਂ ਤਾਂ ਉਸ ਵਿੱਚ ਊਧਮ ਸਿੰਘ ਵੀ ਸ਼ਾਮਲ ਸੀ ਊਧਮ ਸਿੰਘ ਵੀ ਉਸ ਵਿੱਚ ਬੇਹੋਸ਼ ਹੋ ਕੇ ਗਿਰ ਗਿਆ ਸੀ ਜਦੋਂ ਊਧਮ ਸ਼ਿੰਘ ਉੱਠਿਆ ਤਾਂ ਉਸ ਨੇ ਜਨਰਲ ਡਾਇਰ ਤੋਂ ਬਦਲਾ ਲੈਣ ਦੇ ਬਾਰੇ ਸੋਚਿਆ ਅਤੇ ਉਹ ਫਿਰ ਪੰਜਾਬ ਤੋਂ ਬਾਹਰ ਜਾ ਕੇ ਜਨਰਲ ਡਾਇਰ ਨੂੰ ਲੰਡਨ ਵਿੱਚ ਗੋਲੀ ਮਾਰ ਕੇ ਉਸ ਨੇ ਇਸਦਾ ਬਦਲਾ ਲਿਆ ਅਤੇ ਆਪਣੇ ਦੇਸ਼ ਨੂੰ ਅਜ਼ਾਦ ਕਰਵਾਇਆ ਇਹ ਇਹ ਇਹ ਚੀਜ਼ ਊਧਮ ਸਿੰਘ ਦੀ ਮੇਰੇ ਜੀਵਨ 'ਤੇ ਬਹੁਤ ਵੱਡਾ ਪ੍ਰਭਾਵ ਕੀਤਾ ਮੈਨੂੰ ਆਪਣੇ ਦੇਸ਼ 'ਤੇ ਮਾਣ ਹੈ